ਸਾਡੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਰਵਾਇਤੀ ਖੇਡਾਂ ਹਨ ਜਿਵੇਂ ਕਿ ਗੁੱਲੀ ਡੰਡਾ ਹੌਕੀ ਕ੍ਰਿਕਟ ਅਤੇ ਖੋ ਖੋ ਹੈ ਇਹ ਹੋਰ ਵੀ ਕਈ ਤਰ੍ਹਾਂ ਦੀਆਂ ਗੇਮਾਂ ਹਨ ਪਰ ਸਾਡੇ ਖੇਤਰ ਵਿੱਚ ਜ਼ਿਆਦਾਤਰ ਇਹੀ ਖੇਡਾਂ ਖੇਡੀਆਂ ਜਾਂਦੀਆਂ ਹਨ ਵਾਲੀਬੋਲ ਫੁੱਟਬੋਲ ਇਹ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ ਇਹ ਖੇਡਾਂ ਖੁੱਲ੍ਹੇ ਮੈਦਾਨ ਵਿੱਚ ਖੇਡਣ ਵਾਲੀਆਂ ਹਨ ਪਰ ਜਿਹੜੀ ਖੇਡ ਸਾਡੇ ਖੇਤਰ ਵਿੱਚ ਬਹੁਤ ਲੋਕ ਪਸੰਦ ਕਰਦੇ ਹਨ ਉਹ ਹੈ ਕ੍ਰਿਕਟ ਅਤੇ ਅਤੇ ਵੋਲੀਬੋਲ ਕ੍ਰਿਕਟ ਅੱਜ ਮੈਂ ਤੁਹਾਨੂੰ ਕ੍ਰਿਕਟ ਬਾਰੇ ਦੱਸਣ ਜਾ ਰਿਹਾ ਹਾਂ ਕ੍ਰਿਕਟ ਵਿੱਚ ਗਿਆਰਾਂ ਗਿਆਰਾਂ ਖਿਲਾੜੀਆਂ ਦੀਆਂ ਟੀਮਾਂ ਹੁੰਦੀਆਂ ਹਨ ਪਹਿਲਾਂ ਤਾਂ ਉਹਨਾਂ ਦੋਨਾਂ ਟੀਮਾਂ ਵਿੱਚ ਟਾਸ ਹੁੰਦਾ ਹੈ ਜਿਹੜੀ ਟੀਮ ਟਾਸ ਜਿੱਤਦੀ ਹੈ ਉਹ ਪਹਿਲਾਂ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਦਾ ਫੈਸਲਾ ਕਰਦੀ ਹੈ ਜਿਹੜੀ ਟੀਮ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕਰਦੀ ਹੈ ਉਹ ਟੀਮ ਪੂਰੀ ਪਿਚ 'ਤੇ ਅਤੇ ਪੂਰੇ ਮੈਦਾਨ ਵਿੱਚ ਫੀਲਡਿੰਗ ਖਿਲਾਰਦੀ ਹੈ ਹਰ ਇੱਕ ਬੰਦੇ ਨੂੰ ਅਲੱਗ ਅਲੱਗ ਜਗ੍ਹਾ 'ਤੇ ਖਲੋਣ ਵਾਸਤੇ ਕਹਿ ਦਿੱਤਾ ਜਾਂਦਾ ਹੈ ਉਹ ਬੰਦਾ ਉਸ ਜਗ੍ਹਾ 'ਤੇ ਖਲੋ ਕੇ ਬੋਲ ਨੂੰ ਫੜਦਾ ਹੈ ਅਤੇ ਉਸ ਨੂੰ ਵਾਪਸ ਕੀਪਰ ਦੇ ਹੱਥ ਵਿੱਚ ਫੜਾਉਂਦਾ ਹੈ ਬੱਲੇਬਾਜ਼ ਉਸ ਵਕਤ ਦੋ ਹੀ ਮੈਦਾਨ 'ਤੇ ਹੁੰਦੇ ਹਨ ਅਤੇ ਦੂਜੇ ਖੇਡਣ ਵਾਲੇ ਟੀਮਾਂ ਉਹ ਬਾਹਰ ਬੈਠੀ ਹੁੰਦੀ ਹੈ ਇਹ ਖੇਡ ਵਿੱਚ ਬਹੁਤ ਹੀ ਜ਼ਿਆਦਾ ਆਨੰਦ ਆਉਂਦਾ ਹੈ ਕਿਉਂਕਿ ਜਦ ਜਿਹੜੀ ਖੇਡਣ ਵਾਲੀ ਟੀਮ ਹੁੰਦੀ ਹੈ ਮਾਣੀ ਕਿ ਜਿਹੜੀ ਬੱਲੇਬਾਜ਼ੀ ਵਾਲੀ ਟੀਮ ਹੁੰਦੀ ਹੈ ਉਹ ਪਹਿਲਾਂ ਇੱਕ ਸਕੋਰ ਤੈਅ ਕਰਦੀ ਹੈ ਅਤੇ ਇੱਕ ਬੋਰਡ 'ਤੇ ਲਗਾ ਦਿੰਦੀ ਹੈ ਜਦ ਮੰਨ ਲਓ ਤੁਸੀਂ ਦੋ ਸੌ ਸਕੋਰ ਬੋਰਡ ਉੱਤੇ ਲਗਾ ਦਿੱਤੇ ਹੈ ਅਤੇ ਹੁਣ ਜਿਹੜੀ ਬੱਲ ਗੇਂਦਬਾਜ਼ੀ ਵਾਲੀ ਟੀਮ ਹੋਵੇਗੀ ਉਸ ਨੂੰ ਦੋ ਸੌ ਇੱਕ ਸਕੋਰ ਮਾਰ ਕੇ ਜਿੱਤਣਾ ਪਵੇਗਾ ਫਿਰ ਕੁਛ ਸਮੇਂ ਦੇ ਅੰਤਰਾਲ ਨਾਲ ਦੂਸਰੀ ਟੀਮ ਖੇਡਣ ਆ ਜਾਂਦੀ ਹੈ ਜਿਸ ਨਾਲ ਉਹ ਖੇਡਣਾ ਚਾਲੂ ਕਰਦੀ ਹੈ ਅਤੇ ਨਿਯਮਿਤ ਓਵਰਾਂ ਦੇ ਵਿੱਚ ਜਿੰਨੇ ਤੁਸੀਂ ਓਵਰ ਡਿਸਾਈਡ ਕੀਤੇ ਹੋਣਗੇ ਉਹ ਓਵਰਾਂ ਦੇ ਵਿੱਚ ਹੀ ਤੁਹਾਨੂੰ ਟਾਰਗੇਟ ਪੂਰਾ ਕਰਨਾ ਪੈਂਦਾ ਹੈ ਇਸ ਨਾਲ ਇਹ ਗੇਮ ਖੇਡੀ ਜਾਂਦੀ ਹੈ ਇਸ ਵਿੱਚ ਗੁੱਲੀ ਡੰਡਾ ਵਾਲੀਬੋਲ ਇਹ ਖੇਡਾਂ ਵੀ ਬੜੀ ਮਸ਼ਹੂਰ ਹੈ ਗੁੱਲੀ ਡੰਡਾ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਇਸ ਵਿੱਚ ਇੱਕ ਡੰਡਾ ਹੁੰਦਾ ਹੈ ਅਤੇ ਨਾਲ ਇੱਕ ਛੋਟਾ ਜਿਹਾ ਅ ਲੱਕੜ ਦਾ ਬਣਿਆ ਗੁੱਲੀ ਹੁੰਦੀ ਹੈ ਜਿਸ ਨੂੰ ਬੱਚੇ ਜ਼ੋਰ ਦੀ ਮਾਰ ਕੇ ਅਤੇ ਦੂਰ ਸੁੱਟ ਦਿੰਦੇ ਹਨ ਫਿਰ ਉਹ ਗੋਲ ਕਤਾਰੇ ਵਿੱਚ ਸੁੱਟਣੀ ਪੈਂਦੀ ਹੈ ਜਿਸ ਨਾਲ ਜਦ ਅਗਰ ਕੋਈ ਉਹ ਗੁੱਲੀ ਗੋਲ ਕਤਾਰੇ ਵਿੱਚ ਸੁੱਟ ਦਿੰਦਾ ਹੈ ਤਾਂ ਉਹ ਆਊਟ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਖੇਡ ਇਹ ਅੱਗੇ ਵੱਧਦੀ ਜਾਂਦੀ ਹੈ ਅਤੇ ਬੱਚੇ ਖੇਡਦੇ ਰਹਿੰਦੇ ਹਨ ਗਲੀਆਂ ਵਿੱਚ ਵੀ ਬੱਚੇ ਕਈ ਕ੍ਰਿਕਟ ਖੇਡਦੇ ਹਨ ਅਤੇ ਬਹੁਤ ਹੀ ਆਨੰਦ ਮਾਣਦੇ ਹਨ ਇਸ ਵਿੱਚ ਗਲੀ ਵਿੱਚ ਖੇਡਣ ਵਾਲੇ ਬੱਚੇ ਅਲੱਗ ਅਲੱਗ ਕਿਸਮਾਂ ਦੇ ਰੂਲ੍ਹ ਬਣਾ ਲੈਂਦੇ ਹਨ ਧੰਨਵਾਦ